ਸੱਤ ਫਰਵਰੀ ਦੋ ਹਜ਼ਾਰ ਦਸ ਸਤਾਈ ਫਰਵਰੀ ਦੋ ਹਜ਼ਾਰ ਬਾਰ੍ਹਾਂ ਚੌਦ੍ਹਾਂ ਦਸੰਬਰ ਦੋ ਹਜ਼ਾਰ ਬਾਰ੍ਹਾਂ ਬਾਈ ਅਗਸਤ ਦੋ ਹਜ਼ਾਰ ਤੇਰ੍ਹਾਂ ਚੌਵੀ ਜਨਵਰੀ ਦੋ ਹਜ਼ਾਰ ਬਾਈ